ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਜੀ ਹਾਂਜੀ

ਅੱਛਾ ਜੀ ਮੈਮ ਤੁਸੀਂ ਕਿੱਥੋਂ ਬੋਲ਼ ਰਹੇ ਹੋ ਐਕਚੁਲੀ ਅੱਛਾ ਜੀ ਮੈਮ ਤੁਹਾਡਾ ਕਿੰਨਾਂ ਕੁ ਬਜਟ ਹੈ ਅੱਛਾ ਜੀ ਅਤੇ ਤੁਸੀਂ ਤੁਹਾਡਾ ਵਿਆਹ ਦਾ ਪ੍ਰੋਗਰਾਮ ਕਦੋਂ ਹੈ ਅਤੇ ਕਿੰਨੀ ਤਰੀਕ ਨੂੰ ਅੱਛਾ ਜੀ ਅਤੇ ਤੁਸੀਂ ਕੀ ਕੀ ਅਰੇਂਜਮੈਂਟ ਚਾਹੁੰਦੇ ਹੋ ਫੂਡ ਦਾ ਹਾਂਜੀ

ਅੱਛਾ ਜੀ ਹਾਂਜੀ ਕੋਈ ਨਹੀਂ ਅਤੇ ਬਾਕੀ ਸਵੀਟ ਸਵੀਟ 'ਚ ਹੋਰ ਤੁਸੀਂ ਹਾਂਜੀ ਸਾਡੇ ਕੋਲ ਸਬਜ਼ੀ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਹੋਰ ਵੀ ਹੈ ਮਿਕਸ ਸਬਜ਼ੀ ਮਿਕਸ ਵੈੱਜ ਆਦਿ ਸਬਜ਼ੀਆਂ ਏ ਹਾਂਜੀ ਨਹੀਂ ਜੀ ਹਲਵਾਈ ਅਸੀਂ ਆਪ ਹੀ ਭੇਜਾਂਗੇ ਸਾਡਾ ਸਟਾਫ ਬਹੁਤ ਹੀ ਜ਼ਿਆਦਾ ਮਿਹਨਤੀ ਹੈ ਅਸੀਂ ਉਨ੍ਹਾਂ ਨੂੰ ਹੀ ਭੇਜਾਂਗੇ ਨੂੰ ਤਕਰੀਬਨ ਜੀ ਤੁਸੀਂ ਮਤਲਬ ਕਿ ਵਧੀਆ ਫੂਡ ਵਧੀਆ ਫੂਡ ਸਾਫ ਸਫਾਈ ਦਾ ਪੂਰਾ ਪ੍ਰਬੰਧ ਅਤੇ ਬਾਕੀ ਸਵੀਟਸ ਵਗੈਰਾ ਫਿਰ ਫਾਸਟ ਫੂਡ ਵੀ ਨਾਲ ਚਾਹੁੰਦੇ ਤਾਂ ਉਹ ਹੀ ਤਕਰੀਬਨ ਸਾਢੇ ਚਾਰ ਪੰਜ ਲੱਖ ਤੱਕ ਦਾ ਖਰਚਾ ਆ ਜਾਣਾ ਜੀ ਬਾਕੀ ਦੇਖ ਲਉ ਤੁਹਾਡਾ ਕਿੰਨਾਂ ਕੁ ਬਜਟ ਹੈ ਉਸ ਅਕੋਡਿੰਗ ਅਸੀਂ ਕਰ ਦੇਵਾਂਗੇ ਹਾਂਜੀ ਹਾਂਜੀ ਕੋਈ ਨਹੀਂ ਜੀ ਤੁਸੀਂ ਥੋੜ੍ਹੇ ਥੋੜ੍ਹੇ ਕਰ ਕੇ ਹੀ ਦੇ ਦਿਓ ਹਾਂਜੀ ਕੋਈ ਗੱਲ ਨਹੀਂ ਜੀ ਤੁਸੀਂ ਥੋੜ੍ਹਾ ਬਹੁਤਾ ਜੀ ਸਾਈ ਸਾਈ 'ਤੇ ਦੇ ਦਿਓ ਬਾਕੀ ਤੁਸੀਂ ਫਿਰ ਕਰ ਦਿਓ ਬਾਅਦ ਵਿੱਚ ਉਹੀ ਜੀ ਵੀਹ ਕੁ ਹਜ਼ਾਰ ਠੀਕ ਹੈ ਜੀ ਓਕੇ ਜੀ ਓਕੇ ਜੀ ਬਾਏ ਕਰ ਦਿਓ ਜੀ ਫੋਨ